ਪੰਜਾਬ ਵਿੱਚ ਬਹੁਤ ਸਾਰੇ ਮਸ਼ਹੂਰ ਬਜ਼ਾਰ ਜਾਂ ਖਰੀਦਦਾਰੀ ਜ਼ਿਲ੍ਹੇ ਹਨ ਜਿੱਥੇ ਸੈਲਾਨੀਆਂ ਨੂੰ ਜਾਣਾ ਬਹੁਤ ਜ਼ਰੂਰੀ ਜਾਣਾ ਚਾਹੀਦਾ ਹੈ ਪੰਜਾਬ ਵਿੱਚ ਜਿਹੜਾ ਅੰਮ੍ਰਿਤਸਰ ਜੇ ਆਪਾਂ ਅੰਮ੍ਰਿਤਸਰ ਦਾ ਵੇਖੀਏ ਇੱਥੇ ਪਿੰਕ ਪਲਾਜ਼ਾ ਮਾਰਕੀਟ ਆ ਜਿੱਥੇ ਕੱਪੜਿਆਂ ਦੀ ਬਹੁਤ ਵਧੀਆ ਦੁਕਾਨਾਂ ਹਨ ਜਿੱਥੇ ਬਹੁਤ ਵਧੀਆ ਅਤੇ ਅਤੇ ਡਿਜ਼ਾਇਨਰ ਬਹੁਤ ਜ਼ਿਆਦਾ ਵਰਾਇਟੀ ਹੁੰਦੀ ਕੱਪੜੇ ਦੀ ਇਹ ਖਾਲ ਬਜ਼ਾਰ ਮਾਰਕੀਟ ਹੈਗੀ ਉੱਥੇ ਇਲੈਕਟ੍ਰੋਨਿਕਸ ਦਾ ਹੋਰ ਵੀ ਬਥੇਰਾ ਸਮਾਨ ਮਿਲ ਜਾਂਦਾ ਹੈ ਵੋਚਿਸ ਦਾ ਬਹੁਤ ਵਧੀਆ ਮਾਰਕੀਟ ਹੈਗੀ ਉੱਥੋਂ ਲੀਤਾ ਜਾ ਸਕਦਾ ਪਾਪੜ ਬੜੀਆਂ ਦਾ ਬਜ਼ਾਰ ਜੋ ਕਿ ਬਾਹਰੋਂ ਜੋ ਲੋਕ ਆਉਂਦੇ ਇੱਥੋਂ ਦੇ ਪਾਪੜ ਬੜੀਆਂ ਜੋ ਕਿ ਟੇਸਟ ਹੋਰ ਕਿਤੇ ਨਹੀਂ ਮਿਲਦਾ ਇੱਥੋਂ ਪਾਪੜ ਬੜੀਆਂ ਲੈ ਸਕਦਾ ਹੈ ਜੇ ਬਜ਼ਾਰ ਹੋਰ ਦੇਖਿਆ ਜਾਵੇ ਸੂਟਸ ਵਗੈਰਾ ਖਰੀਦਣੇ ਹੋਣ ਉਹ ਕੱਟੜਾ ਜੈਮਲ ਸਿੰਘ ਹੈਗਾ ਉਹ ਮੇਨਲੀ ਮਾਰਕੀਟ ਸੂਟਸ ਵਗੈਰਾ ਦੀ ਹੈ ਕੋਈ ਰੈਡੀਮੇਡ ਚਾਹੀਦਾ ਹੋਵੇ ਕੋਈ ਡਰੈਸਿਸ ਚਾਹੀਦੀਆਂ ਹੋਣ ਅਨਸਟਿਚ ਸੂਟ ਚਾਹੀਦੇ ਹੋਣ ਉਹ ਉੱਥੋਂ ਲੈ ਸਕਦਾ ਅਤੇ ਇੱਕ ਮਾਰਕੀਟ ਚਿੱਟਾ ਕੱਟੜਾ ਵੀ ਹੈਗੀ ਹੈ ਚਿੱਟੇ ਕੱਟੜੇ ਬਹੁਤ ਜ਼ਿਆਦਾ ਸੂਟਸ ਦੀ ਡਿਜ਼ਾਇਨਰ ਸੂਟਸ ਦੀ ਡਰੈਸਿਸ ਦੀ ਸ਼ੋਪਸ ਹੈਗੀ ਹੈ ਬਹੁਤ ਜ਼ਿਆਦਾ ਹੈਗੀ ਆ ਅਤੇ ਬਹੁਤ ਜ਼ਿਆਦਾ ਵਰਾਇਟੀ ਮਿਲ ਸਕਦੀ ਹੈ ਮੇਨਲੀ ਜੇ ਤੁਸੀਂ ਵਿਆਹ ਦੀ ਸ਼ੋਪਿੰਗ ਕਰਨੀ ਹੋਵੇ ਤਾਂ ਇੱਥੇ ਗੁਰੂ ਬਜ਼ਾਰ ਹੈਗਾ ਜਿੱਥੇ ਚੂੜੇ ਕਲੀਰੇ ਹਰ ਵਿਆਹ ਦਾ ਹਰ ਤਰ੍ਹਾਂ ਦਾ ਸਮਾਨ ਉੱਥੇ ਮਿਲ ਜਾਂਦਾ ਬਹੁਤ ਸੋਹਣੀ ਜਵੈਲਰੀ ਆਰਟੀਫਿਸ਼ਅਲ ਜਵੈਲਰੀ ਹੋਰ ਵੀ ਬਥੇਰੀ ਆ ਸਮਾਨ ਬਹੁਤ ਵਧੀਆ ਮਿਲਦਾ ਉੱਥੇ ਬਹੁਤ ਜ਼ਿਆਦਾ ਵਧੀਆ ਹੈਗੀ ਮਾਰਕੀਟਸ ਜੇ ਕੋਈ ਬਾਹਰੋਂ ਕੋਈ ਸੈਲਾਨੀ ਆਵੇ ਤਾਂ ਉਹਨਾਂ ਨੂੰ ਮਾਰਕਿਟਾਂ 'ਚ ਜ਼ਰੂਰ ਘੁੰਮਣਾ ਚਾਹੀਦਾ ਅਤੇ ਜੇ ਸ਼ੋਪਿੰਗ ਕਰਨੀ ਹੋਵੇ ਤਾਂ ਇਹ ਜਗ੍ਹਾਵਾਂ ਬਹੁਤ ਜ਼ਿਆਦਾ ਵਧੀਆ ਹੈਗੀ ਹੈ ਅਤੇ ਮੇਨ ਦੇਖਿਆ ਜਾਵੇ ਲਾਰੈਂਸ ਰੋਡ ਵੀ ਹੈਗਾ ਸ਼ੋਪਿੰਗ ਕਰਨ ਵਾਸਤੇ ਉੱਥੇ ਬਹੁਤ ਵਧੀਆ ਸ਼ੋਪਸ ਹੈਗੀਆਂ ਬਹੁਤ ਵਧੀਆ ਮਾਰਕੀਟ ਹੈਗੀ ਆ ਜੇ ਜਿਨ੍ਹਾਂ ਦਾ ਟੇਸਟ ਬਹੁਤ ਜ਼ਿਆਦਾ ਅੱਛਾ ਉਹ ਉੱਥੇ ਜਾ ਸਕਦੇ ਹਨ